ਮੈਨੂੰ ਲੱਗਦਾ ਪੁਰਾਣੇ ਸਮਿਆਂ ਵਿੱਚ ਲਿੰਗ ਅਸਮਾਨਤਾ ਦੇ ਅਜਿਹੇ ਵਿਤਕਰੇ ਦੇ ਮੁੱਦੇ ਬਹੁਤ ਜ਼ਿਆਦਾ ਪ੍ਰਚਲਿਤ ਸੀਗੇ ਅਤੇ ਛੋਟੀ ਉਮਰ ਦੇ ਵਿੱਚ ਹੀ ਨਾਬਾਲਗ ਉਮਰ ਦੇ ਵਿੱਚ ਹੀ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਅਤੇ ਉਹਨੂੰ ਸਿੱਖਿਆ ਪ੍ਰਦਾਨ ਕਰਨ ਦਾ ਅਵਸਰ ਪ੍ਰਾਪਤ ਨਹੀਂ ਹੁੰਦਾ ਸੀ ਮੰਨਿਆਂ ਜਾਂਦਾ ਸੀ ਕਿ ਸਿੱਖਿਆ ਸਿਰਫ਼ ਮੁੰਡੇ ਹੀ ਲੈ ਸਕਦੇ ਨੇ ਕੁੜੀਆਂ ਨਹੀਂ ਲੈ ਸਕਦੀਆਂ ਸੋ ਮੈਨੂੰ ਲੱਗਦਾ ਕਿ ਸੁਸਾਇਟੀ ਦੇ ਵਿੱਚ ਸਾਰਿਆਂ ਨੂੰ ਰਾਈਟ ਹੋਣਾ ਚਾਹੀਦਾ ਕਿ ਉਹ ਆਪਣੇ ਅਕੋਡਿੰਗ ਆਪਣੀ ਲਾਈਫ਼ ਨੂੰ ਲੀਡ ਕਰਨ ਬਿਨਾਂ ਕਿਸੇ ਡਿਸਕ੍ਰੀਮੀਨੇਸ਼ਨ ਦੇ ਇੱਕ ਸਟੇਟ ਤਾਂ ਹੀ ਕੁਛ ਅਚੀਫ਼ ਕਰ ਸਕਦੀ ਹੈ ਜੇ ਉੱਥੇ ਕਾਸਟ ਜੈਂਡਰ ਕਲਰ ਪ੍ਰੋਫੈਸ਼ਨ ਦਾ ਵਿਤਕਰਾ ਨਾ ਕੀਤਾ ਜਾਵੇ ਹੁਣ ਤਾਂ ਜੈਂਡਰ ਇਕੁਆਲਿਟੀ ਇੱਕ ਹਿਊਮਨ ਰਾਈਟ ਹੈ ਸਿੱਖਿਆ ਪ੍ਰਣਾਲੀ ਲਿੰਗ ਅਸਮਾਨਤਾ ਦੇ ਵਿਤਕਰੇ ਦੇ ਮੁੱਦੇ ਨੂੰ ਦੂਰ ਕਰਨ ਵਿੱਚ ਬਹੁਤ ਮੇਨ ਭੂਮਿਕਾ ਨਿਭਾ ਰਹੀ ਹੈ ਹੁਣ ਅੱਜ ਕੱਲ੍ਹ ਦੇ ਯੁੱਗ ਵਿੱਚ ਇਹ ਬਹੁਤ ਜ਼ਿਆਦਾ ਘੱਟ ਗਿਆ ਲਿੰਗ ਅਸਮਾਨਤਾ ਦਾ ਦੌਰ ਉਹਨਾਂ ਸਾਰਿਆਂ ਨੂੰ ਇਕੁਅਲ ਮੰਨਿਆਂ ਜਾਂਦਾ ਹੈ ਇਹ ਸੰਭਵ ਹੋਇਆ ਸਿਰਫ਼ ਸਿੱਖਿਆ ਪ੍ਰਣਾਲੀ ਦੇ ਨਾਲ਼ ਹੀ ਇਹਦਾ ਬਹੁਤ ਜ਼ਿਆਦਾ ਇਫੈਕਟ ਪਿਆ ਲਿੰਗ ਅਸਮਾਨਤਾ ਦੇ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਕੁੜੀ ਅਤੇ ਮੁੰਡੇ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਹਰ ਇੱਕ ਨਾਗਰਿਕ ਦਾ ਸਮਾਜਿਕ ਵਿਕਾਸ ਕੀਤਾ ਗਿਆ ਹੈ ਅਗਰ ਕਿਸੇ ਦੇਸ਼ ਵਿੱਚ ਇਕੁਆਲਿਟੀ ਵਰਗੀਆਂ ਚੀਜ਼ਾਂ ਨਾ ਹੋਣ ਤਾਂ ਉੱਥੇ ਉਹ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ ਹੈ